ਆਪਣੇ ਘਰ ਦੇ ਵਿੱਚ ਹਮੇਸ਼ਾ ਖਾਣਾ ਬਣਾਉਣ ਤੋਂ ਪਹਿਲਾਂ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਸਿਲੰਡਰ ਹੈ ਉਹ ਬੱਚਿਆਂ ਤੋਂ ਦੂਰੀ ਤੇ ਰੱਖਣੇ ਚਾਹੀਦੇ ਹੈ ਕਿਉਂਕਿ ਜਿਹੜੇ ਛੋਟੇ ਬੱਚੇ ਹੁੰਦੇ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਵੇਂ ਅਸੀਂ ਸਿਲੰਡਰ ਜਿਹੜਾ ਐੱਲ ਪੀ ਜੀ ਸਿਲੰਡਰਸ ਹੁੰਦੇ ਕਿੱਦਾਂ ਗੈਸ ਔਨ ਕਰਦੇ ਹੈ ਕਿੱਦਾਂ ਔਫ ਕਰਦੇ ਹੈ ਹੈ ਨਾ ਅਤੇ ਜਿਹੜੇ ਇਸ ਘਰ ਦੇ ਵਿੱਚ ਜਿਹੜੇ ਵੱਡੇ ਹੁੰਦੇ ਜਿਹੜੇ ਖਾਣਾ ਬਣਾਉਂਦੇ ਹੈ ਹੈ ਨਾ ਉਨ੍ਹਾਂ ਨੂੰ ਇਸ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਦੂਜੀ ਗੱਲ ਇਹ ਹੈ ਜਦੋਂ ਵੀ ਅਸੀਂ ਖਾਣਾ ਬਣਾ ਕੇ ਹੱਟਦੇ ਹੈ ਜਾਂ ਬਣਾਉਣ ਤੋਂ ਪਹਿਲਾਂ ਹੀ ਥੋੜ੍ਹੀ ਦੇਰ ਪਹਿਲਾਂ ਹੀ ਆਪਾਂ ਨੂੰ ਔਨ ਕਰਨਾ ਚਾਹੀਦਾ ਨੀਚੇ ਤੋਂ ਸਿਲੰਡਰ ਤਾਂ ਜੋ ਜਿਹੜੀ ਉਹ ਗੈਸ ਹੈ ਉਹ ਵੇਸਟ ਨਾ ਹੋਅਵੇ ਤੇ ਦੂਜਾ ਇਹ ਹੁੰਦਾ ਹੈ ਕਿ ਜਦੋਂ ਘਰ ਦੇ ਵਿੱਚ ਛੋਟੇ ਬੱਚੇ ਹੁੰਦੇ ਹੈ ਉਹਨਾਂ ਦੀ ਵੀ ਅਸੀਂ ਨਿਗਰਾਨੀ ਰੱਖ ਸਕੀਏ ਅਤੇ ਜਦੋਂ ਵੀ ਅਸੀਂ ਖਾਣਾ ਬਣਾ ਕੇ ਹਟਣਾ ਹੈ ਅਤੇ ਉਹਦੇ ਵਿੱਚ ਕੀ ਕਰਨਾ ਅਸੀਂ ਬਾਅਦ ਵਿੱਚ ਖਾਣਾ ਬਣਾਉਣ ਤੋੋਂ ਬਾਅਦ ਸਿਲੰਡਰ ਚੰਗੀ ਤਰ੍ਹਾਂ ਬੰਦ ਕਰ ਦੇਣਾ ਅਤੇ ਉਹਨੂੰ ਚੈੱਕ ਕਰਨਾ ਕਿ ਗੈਸ ਲੀਕ ਤਾਂ ਨਹੀਂ ਕਰਦੀ ਹੈ